ਗੋਡਿਆਂ ਦਾ ਦਰਦ ਹੋਣ ਦੇ ਬਹੁਤ ਕਾਰਨ ਹਨ ਜਿਵੇਂ ਕਿ ਸੱਟ ਲੱਗਣਾ ਜ਼ਿਆਦਾ ਵਰਤੋਂ ਵਿੱਚ ਲੈ ਕੇ ਆਉਣਾ ਗਠੀਆ ਹੋਣ ਕਾਰਨ ਜਾਂ ਸਰੀਰ ਭਾਰਾ ਹੋਣ ਕਾਰਨ ਹੁੰਦਾ ਹੈ ਸਾਡੇ ਪਿੰਡ ਵਿੱਚ ਗੋਡਿਆਂ ਦੇ ਦਰਦ ਨੂੰ ਠੀਕ ਕਰਨ ਲਈ ਬਹੁਤ ਤਰ੍ਹਾਂ ਦੇ ਪ੍ਰਸਿੱਧ ਘਰੇਲੂ ਉਪਚਾਰ ਕੀਤੇ ਜਾਂਦੇ ਹਨ ਜਿਵੇਂ ਕਿ ਹਲਦੀ ਦਾ ਲੇਪ ਬਣਾ ਕੇ ਲਗਾਇਆ ਜਾਂਦਾ ਹੈ ਤਿਲਾਂ ਦੇ ਤੇਲ ਵਿੱਚ ਲਸਣ ਦੀਆਂ ਪੋਥੀਆਂ ਪਾ ਕੇ ਗਰਮ ਕਰਕੇ ਗੋਡਿਆਂ ਦੀ ਮਾਲਸ਼ ਕੀਤੀ ਜਾਂਦੀ ਹੈ ਗੋਡਿਆਂ ਨੂੰ ਪਹਿਲਾਂ ਬਰਫ ਦੇ ਪਾਣੀ ਦੀਆਂ ਠੰਡੀਆਂ ਪੱਟੀਆਂ ਅਤੇ ਬਾਅਦ ਵਿੱਚ ਸੇਕ ਦਿੱਤਾ ਜਾਂਦਾ ਹੈ ਸੈਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਸਾਡੇ ਪਿੰਡ ਵਿੱਚ ਗੋਡਿਆਂ ਦਾ ਦਰਦ ਦੂਰ ਕਰਨ ਲਈ ਹਲਦੀ ਅਦਰਕ ਪਾ ਕੇ ਪਾਣੀ ਉਬਾਲ ਕੇ ਪੀਣ ਨੂੰ ਦਿੱਤਾ ਜਾਂਦਾ ਹੈ ਇਸ ਨਾਲ ਗੋਡਿਆਂ ਦੇ ਦਰਦ ਵਿੱਚ ਰਾਹਤ ਮਿਲਦੀ ਹੈ ਸਭ ਤੋਂ ਮਹੱਤਵਪੂਰਨ ਘਰੇਲੂ ਉਪਚਾਰ ਅੱਧ ਗਰਮ ਪਾਣੀ ਵਿੱਚ ਲੂਣ ਪਾ ਕੇ ਪਾਣੀ ਵਿੱਚ ਬਾਲਟੀ ਗੋਡੇ ਪਾਉਣ ਨੂੰ ਕਿਹਾ ਜਾਂਦਾ ਹੈ ਪੀੜਤ ਬੰਦੇ ਨੂੰ

ਥੋਟਿਕਸ ਜੁੱਤੇ ਪਾਉਣ ਨੂੰ ਕਿਹਾ ਜਾਂਦਾ ਹੈ ਲਸਣ ਨੂੰ ਕੁੱਟ ਕੇ ਸਵੇਰ ਸ਼ਾਮ ਖਾਣ ਨਾਲ ਗੋਡਿਆਂ ਦਾ ਦਰਦ ਠੀਕ ਹੁੰਦਾ ਹੈ ਬਰਗਦ ਦੇ ਦਰਖਤ ਦੀ ਟਹਿਣੀ ਨੂੰ ਪਾਊਡਰ ਬਣਾ ਕੇ ਪੀਣ ਨੂੰ ਗੋਡਿਆਂ ਦੇ ਦਰਦ ਲਈ ਵਧੀਆ ਮੰਨਿਆ ਜਾਂਦਾ ਹੈ